ਭਾਰਤ ਵਿੱਚ ਬਹੁਤ ਹੀ ਪ੍ਰਸਿੱਧ ਗੁਰੂ ਹਨ ਯੋਗਾ ਗੁਰੂ ਜਿਹਨਾਂ ਦਾ ਨਾਮ ਹੈ ਬਾਬਾ ਰਾਮਦੇਵ ਉਹਨਾਂ ਦਾ ਅਸਲੀ ਨਾਮ ਠਾਕੁਰ ਰਾਮ ਕਿਸ਼ਨ ਜੀ ਹਨ ਅਤੇ ਉਹਨਾਂ ਦਾ ਜਨਮ ਪੱਚੀ ਦਸੰਬਰ ਉੱਨੀ ਸੌ ਸਿਕਸਟੀ ਫਾਈਵ ਵਿੱਚ ਹੋਇਆ ਸੀ ਉਹ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਹਨ ਅਤੇ ਉਹ ਭਾਰਤ ਦੇ ਹੀ ਰਹਿਣ ਵਾਲੇ ਹਨ ਉਹਨਾਂ ਨੂੰ ਯੋਗ ਅਤੇ ਇਹ ਵੈਬਸਾਏ ਦੇ ਲਈ ਜਾਣਿਆ ਜਾਂਦਾ ਹੈ ਠੀਕ ਹੈ ਉਹ ਤੁਹਾਨੂੰ ਉਹ ਮੈਨੂੰ ਇੱਦਾਂ ਪ੍ਰੇਰਿਤ ਕਰਦੇ ਹਨ ਕਿ ਤੁਸੀਂ ਯੋਗਾ ਕਰੋ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਉਹ ਹਰ ਇੱਕ ਤਰ੍ਹਾਂ ਦਾ ਯੋਗਾ ਕਰਦੇ ਹਨ ਉਹ ਸੱਠ ਸਾਲ ਦੇ ਹੋ ਕੇ ਵੀ ਅੱਜ ਇੱਦਾਂ ਦਿਖਦੇ ਹਨ ਜਿੱਦਾਂ ਉਹ ਬੁੱਢੇ ਹੋਏ ਹੀ ਨਹੀਂ ਉਹ ਦਿਨ ਰਾਤ ਯੋਗਾ ਕਰਦੇ ਹਨ ਅਤੇ ਬਾਕੀਆਂ ਨੂੰ ਵੀ ਇਹ ਸ਼ਿਕਸ਼ਾ ਦਿੰਦੇ ਹਨ ਕਿ ਤੁਸੀਂ ਵੀ ਯੋਗਾ ਕਰੋ ਅਤੇ ਰਾ ਬਾਬਾ ਰਾਮਦੇਵ ਜਗ੍ਹਾ ਜਗ੍ਹਾ ਸਵੈਮ ਜਾਕਰ ਆਪਣਾ ਯੋਗ ਸ਼ੀਰੀਵਰੋ ਕਾ ਆਯੋਜਨ ਕਰਦੇ ਆ ਜਿੱਦਾਂ ਉਹ ਥਾਂ ਥਾਂ ਜਾ ਕੇ ਆਪਣੇ ਟੈਂਟ ਲਵਾ ਕੇ ਉੱਥੇ ਯੋਗਾ ਪ੍ਰਸਤੁਤ ਕਰਦੇ ਹਨ ਜਿਹੜੇ ਉਹਨਾਂ ਨੂੰ ਪਸੰਦ ਲੋਕ ਕਰਦੇ ਹਨ ਉਹ ਉੱਧਰ ਆਉਂਦੇ ਹਨ ਅਤੇ ਆ ਕੇ ਉਹਨਾਂ ਦੇ ਦੁਆਰਾ ਦੱਸੇ ਗਏ ਯੋਗ ਕਰਦੇ ਹਨ